ਨੌਂ ਜਨਵਰੀ ਦੋ ਹਜ਼ਾਰ ਚਾਰ ਤੇਰ੍ਹਾਂ ਜੂਨ ਦੋ ਹਜ਼ਾਰ ਇੱਕ ਪੰਦਰ੍ਹਾਂ ਜਨਵਰੀ ਦੋ ਹਜ਼ਾਰ ਚੌਦ੍ਹਾਂ ਤੇਈ ਜਨਵਰੀ ਦੋ ਹਜ਼ਾਰ ਸੱਤ ਤੇਰ੍ਹਾਂ ਜਨਵਰੀ ਦੋ ਹਜ਼ਾਰ ਤੇਰ੍ਹਾਂ